ਅੱਜ ਕੱਲ ਦਵਾਈਆਂ ਦਾ ਕਫਾਇਤੀ ਨੀ ਹਨ ਪਰ ਸਾਨੂੰ ਅੱਜ ਕੱਲ ਹੁਣ ਸਰਕਾਰ ਜੋ ਕੀ ਸਰਕਾਰੀ ਹਸਪਤਾਲ ਜੋ ਉਹਨਾਂ ਮੋਦੀਖਾਨੇ ਵਿੱਚੋਂ ਦਵਾਈ ਮਿਲ ਫਰੀ ਮਿਲ ਜਾਂਦੀ ਹੈ ਇਹਦੇ ਮੋਦੀਖਾਨਾ ਮੈਡੀਕਲ ਖੁੱਲਿਆ ਹੈ ਹੈ ਜਿਸ ਕੰਮ ਦੇ ਵਿੱਚ ਸਾਨੂੰ ਘੱਟ ਰੇਟਾਂ ਤੇ ਦਵਾਈ ਮਿਲ ਜਾਂਦੀ ਹੈ ਪਰ ਦਵਾਈਆਂ ਤਾਂ ਸਾਨੂੰ ਲੈਣੀਆਂ ਹੀ ਪੈਂਦੀਆਂ ਨੇ ਸਾਡਾ ਦਸ ਪੰਦਰਾਂ ਪਰਸੈਂਟ ਆਮਦਨੀ ਦਾ ਹਿੱਸਾ ਦਵਾਈਆਂ ਦੇ ਵਿੱਚ ਹੀ ਚਲਾ ਜਾਂਦਾ ਹੈ ਦਵਾਈਆਂ ਸਾਨੂੰ ਸਰਕਾਰੀ ਹਸਪਤਾਲ ਵਿੱਚ ਕੁਝ ਦਵਾਈਆਂ ਸਾਨੂੰ ਫਰੀ ਦਿੱਤੀਆਂ ਜਾਂਦੀਆਂ ਹਨ ਤੇ ਕੁਝ ਦਵਾਈਆਂ ਸਾਨੂੰ ਜੋ ਕੀ ਬਾਹਰੋਂ ਹੀ ਲੈਣੀਆਂ ਪੈਂਦੀਆਂ ਹਨ ਜਿਸ ਕਰਕੇ ਸਾਡਾ ਦਵਾਈਆਂ ਦੇ ਘੱਟੋ ਘੱਟ ਦਸ ਪੰਦਰਾਂ ਪਰਸੈਂਟ ਖਰਚਾ ਆਮਦਨੀ ਦੇ ਵਿੱਚੋਂ ਸਾਨੂੰ ਖਰਚ ਕਰਨਾ ਪੈਂਦਾ ਹੈ ਪਰ ਹੁਣ ਜਿਵੇਂ ਮੋਦੀ ਸਰਕਾਰ ਨੇ ਮੋਦੀਖਾਨਾ ਦਵਾਈ ਸਰਕਾਰੀ ਮੈਡੀਕਲ ਖੋਲਿਆ ਹੈ ਉਹਦੇ ਵਿੱਚੋਂ ਸਾਨੂੰ ਘੱਟ ਰੇਟਾਂ ਤੇ ਦਵਾਈਆਂ ਉਪਲਬਧ ਹੋ ਜਾਂਦੀਆਂ ਹਨ ਜਿਸ ਕਾਰਨ ਸਾਨੂੰ ਬਹੁਤ ਹੀ ਥੋੜਾ ਬਹੁਤਾ ਵੀ ਫਾਇਦਾ ਹੋ ਰਿਹਾ ਹੈ ਇਸ ਕਰਕੇ ਸਰਕਾਰ ਨੂੰ ਹੋਰ ਚਾਹੀਦਾ ਹੈ ਵੱਧ ਤੋਂ ਵੱਧ ਸਾਨੂੰ ਤਕਰੀਬਨ ਸਾਰੀਆਂ ਦਵਾਈਆਂ ਹੀ ਸਰਕਾਰੀ ਹਸਪਤਾਲ ਵਿੱਚੋਂ ਫਰੀ ਦਿੱਤੀਆਂ ਜਾਣ ਤਾਂ ਕੀ ਗਰੀਬ ਜੋ ਕੀ ਆਪਣਾ ਇਲਾਜ ਮੁਫਤ ਕਰਾ ਸਕਣ ਇਸ ਕਰਕੇ ਸਰਕਾਰ ਨੂੰ ਵੀ ਸਾਨੂੰ ਵਾਰ ਵਾਰ ਬੇਨਤੀ ਕਰਦੇ ਹਾਂ ਕੀ ਵੱਧ ਤੋਂ ਵੱਧ ਸਾਨੂੰ ਦਵਾਈਆਂ ਜੋ ਕੀ ਸਰਕਾਰੀ ਹਸਪਤਾਲ ਵਿੱਚੋਂ ਫਰੀ ਕਰਵਾ ਦਿੱਤੀ ਹਨ ਜੋ ਕੀ ਗਰੀਬ ਬੰਦਾ ਆਪਣਾ ਇਲਾਜ ਢੰਗ ਸਿਰ ਕਰਵਾ ਸਕੇ